ਵਿਆਹ ਵਾਲੇ ਘਰ ਵਿੱਚ ਵਿਆਹ ਤੋਂ ਦਸ ਦਿਨ ਪਹਿਲਾਂ ਲੋਕ ਗੀਤ ਗਾਉਣੇ ਸ਼ੁਰੂ ਹੋ ਜਾਂਦੇ ਹਨ ਜਿਹਨਾਂ ਵਿੱਚ ਜੇ ਤਾਂ ਕੁੜੀ ਦਾ ਵਿਆਹ ਹੋਵੇ ਤਾਂ ਸੁਹਾਗ ਗਾਏ ਜਾਂਦੇ ਹਨ ਅਗਰ ਮੁੰਡੇ ਦਾ ਵਿਆਹ ਹੋਵੇ ਤਾਂ ਘੋੜੀਆਂ ਗਾਈ ਜਾਂਦੀਆਂ ਹਨ ਜਿਹਨਾਂ ਵਿੱਚ ਕਿ ਘਰ ਆ ਕੇ ਆਲੇ ਦੁਆਲੇ ਵਾਲੀ ਗੁਆਂਢਣਾਂ ਰਿਸ਼ਤੇਦਾਰ ਵਗੈਰਾ ਸ਼ਾਮਿਲ ਹੁੰਦੇ ਹਨ ਅਤੇ ਗਾਣੇ ਗਾਉਂਦੇ ਹਨ ਲੋਕ ਗੀਤ ਗਾਉਂਦੇ ਹਨ ਇਹ ਲੋਕ ਗੀਤ ਮੁੰਡੇ ਨੂੰ ਜਾਂ ਕੁੜੀ ਨੂੰ ਉਹਨਾਂ ਦੇ ਜੀਵਨ ਬਾਰੇ ਅੱਗੇ ਦੱਸਦੇ ਆ ਵੀ ਉਹਨਾਂ ਦੇ ਜੀਵਨ ਵਿੱਚ ਕੀ ਕੀ ਹੁੰਦਾ ਹੈ ਹੋ ਗਿਆ ਹੋਣ ਵਾਲਾ ਏ ਆਦਿ ਅਤੇ ਫਿਰ ਜਦੋਂ ਵਿਆਹ ਨੂੰ ਤਿੰਨ ਕੁ ਦਿਨ ਰਹਿ ਜਾਂਦੇ ਹੈ ਤਾਂ ਮ ਪਹਿਲੇ ਦਿਨ ਬਟਨਾ ਲੱਗਦਾ ਹੈ ਬਟਨੇ ਵਿੱਚ ਬਟਨਾ ਇਸ ਲਈ ਲਗਾਇਆ ਜਾਂਦਾ ਤਾਂ ਕਿ ਉਹਨਾਂ ਦਾ ਰੰਗ ਰੂਪ ਜਿਹੜਾ ਹੈਗਾ ਕਿ ਨਿਖਰ ਕੇ ਆਵੇ ਅਤੇ ਦੈਨ ਅਗਲੇ ਦਿਨ ਮਹਿੰਦੀ ਦੀ ਰਸਮ ਹੁੰਦੀ ਹੈ ਮਹਿੰਦੀ ਦੀ ਮਹਿੰਦੀ ਦੇ ਵਿੱਚ ਵੀ ਕਾਫੀ ਰਿਸ਼ਤੇਦਾਰ ਅਤੇ ਲੋਕ ਸ਼ਾਮਿਲ ਹੁੰਦੇ ਹਨ ਅਤੇ ਅਗਲੇ ਦਿਨ ਵਿਆਹ ਹੁੰਦਾ ਹੈ ਵਿਆਹ ਵਿੱਚ ਵੀ ਕੁਝ ਇੱਦਾਂ ਦੀਆਂ ਰਸਮਾਂ ਹੁੰਦੀਆਂ ਹਨ ਜੋ ਮੇਨ ਰ ਮਾਇਨੇ ਰੱਖਦੀਆਂ ਹਨ ਜਿਵੇਂ ਕਿ ਕਈਆਂ ਦੇ ਫੇਰੇ ਹੁੰਦੇ ਹੈ ਕਈਆਂ ਦੇ ਲਾਵਾਂ ਹੁੰਦੀਆਂ ਹਨ ਅਤੇ ਵਿਆਹ ਤੋਂ ਅਗਲੇ ਦਿਨ ਹੀ ਪਗ ਫੇਰੇ ਦੀ ਰਸਮ ਹੁੰਦੀ ਹੈ ਇਹਦੇ ਵਿੱਚ ਵੀ ਸਭ ਰਿਸ਼ਤੇਦਾਰ ਸ਼ਾਮਿਲ ਹੁੰਦੇ ਹਨ ਅਤੇ ਲੜਕੀ ਨੂੰ ਸ਼ਗਨ ਦਿੰਦੇ ਹਨ